ਛੱਬੀ ਜਨਵਰੀ ਉੱਨੀ ਸੌ ਪੰਜਾਹ ਸਤਾਰਾਂ ਫਰਵਰੀ ਉੱਨੀ ਸੌ ਨੜ੍ਹਿੰਨਵੇਂ ਚੌਵੀ ਜਨਵਰੀ ਉੱਨੀ ਸੌ ਉਣਾਨਵੇਂ ਚੌਵੀ ਨਵੰਬਰ ਦੋ ਹਜ਼ਾਰ ਸੌਲਾਂ ਸਤਾਰਾਂ ਅਗਸਤ ਦੋ ਹਜ਼ਾਰ ਪੰਦਰਾਂ